ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਤੁਸੀਂ ਇੱਥੋਂ ਗੁਰਦੁਆਰਾ ਕਮੇਟੀ ਤੋਂ ਬੋਲਦੇ ਹੋ ਹਾਂਜੀ ਜੀ ਮੈਂ ਪੁੱਛਣਾ ਸੀਗਾ ਜਿਹੜੇ ਬੱਚਿਆਂ ਨੂੰ ਜਿਹੜਾ ਪਾਠ ਵਗੈਰਾ ਸਿਖਾਇਆ ਜਾਂਦਾ ਉਹਦੇ ਬਾਰੇ ਮੈਂ ਜਾਣਕਾਰੀ ਲੈਣੀ ਸੀਗੀ ਜਿਹੜਾ ਵਾਹਿਗੁਰੂ ਜੀ ਜਿਹੜਾ ਪਾਠ ਹੈ ਉਹ ਕਿਹੜੀਆਂ ਕਿਹੜੀਆਂ ਬਾਣੀਆਂ ਦਾ ਕਰਵਾਇਆ ਜਾਂਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਜੇ ਇਸ ਜਿ ਜਿਹੜੀ ਸੰਥਿਆ ਕਰਵਾਈ ਜਾਂਦੀ ਹੈ ਇਹ ਬੱਚਿਆਂ ਨੂੰ ਕਿਸ ਟਾਈਮ ਕਰਵਾਈ ਜਾਂਦੀ ਹੈ ਹਾਂਜੀ ਠੀਕ ਠੀਕ ਹੈ ਜੀ ਅਤੇ ਬੱਚਿਆਂ ਦੀ ਜਿਹੜੀ ਹੈਗੀ ਆ ਡੈਸ ਡਰੈਸ ਵਗੈਰਾ ਕਿਵੇਂ ਵੀ ਉਹਨਾਂ ਦੀ ਕੋਈ ਹੈਗੀ ਹੈ ਡਰੈਸ ਵਗੈਰਾ ਕਿਹੜੀ ਲੱਗੀ ਹੋਈ ਹੈ ਹਾਂਜੀ ਠੀਕ ਹੈ ਜੀ ਅਤੇ ਦਸਤਾਰ ਦੇ ਰੰਗ ਕਿਹੜੇ ਕਿਹੜੇ ਹੋਣਗੇ ਜੇ ਚੁੰਨੀ ਦਾ ਰੰਗ ਕਿਹੜਾ ਹੋਵੇਗਾ ਜੀ ਹਾਂਜੀ ਠੀਕ ਹੈ ਜੀ ਵੀ ਚਿੱਟਾ ਹੋਵੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅਤੇ ਜਿਹੜਾ ਹੈਗਾ ਬੱਚਾ ਵੀ ਕੋਈ ਉਮਰ ਦੀ ਹੈ ਤਾਂ ਨਹੀਂ ਕਿ ਜਿੰਨੇ ਮਰਜ਼ੀ ਸਾਲ ਦਾ ਬੱਚਾ ਆ ਸਕਦਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਠੀਕ